ਮੈਂ ਪਟਿਆਲੇ ਸ਼ਹਿਰ ਵਿੱਚ ਰਹਿੰਦੀ ਹਾਂ ਅਤੇ ਮੇਰੇ ਘਰ ਦੇ ਨੇੜੇ ਕੁਛ ਟਰੈਵਲ ਕੰਪਨੀਆਂ ਅਤੇ ਟਰੈਵਲ ਏਜੰਟ ਹਨ ਜੋ ਕਿ ਬੱਚਿਆਂ ਨੂੰ ਘੁੰਮਣ ਫਿਰਨ ਅਤੇ ਉਹਨਾਂ ਨੂੰ ਬਾਹਰ ਬਾਰੇ ਘੁੰਮਣ ਦਾ ਮਕ ਅਵਸਰ ਦਿੰਦੇ ਹਨ ਅਤੇ ਉਹਨਾਂ ਨੂੰ ਪੂਰਾ ਗਾਈਡ ਕਰਦੇ ਹਨ ਮੈਂ ਆਪਣੀ ਸਟੱਡੀ ਵਿੱਚ ਬਹੁਤ ਬਿਜ਼ੀ ਹਾਂ ਇਸ ਕਰਕੇ ਮੈਨੂੰ ਅੱਜ ਤੱਕ ਆਪਣੇ ਸ਼ਹਿਰ ਦੇਸ਼ ਬ ਤੋਂ ਬਾਹਰ ਘੁੰਮਣ ਦਾ ਮੌਕਾ ਨਹੀਂ ਮਿਲਿਆ ਪਰ ਮੈਨੇ ਇਹਨਾਂ ਦਾ ਬਹੁਤ ਨਾਮ ਸੁਣਿਆ ਹੈ ਅਤੇ ਮੋਬਾਇਲ ਅਖ਼ਬਾਰਾਂ ਵਿੱਚ ਵੀ ਇਹਨਾਂ ਦੀ ਕਾਫ਼ੀ ਐਡਵਰਟੀਜਮੈਂਟ ਦੇਖੀ ਹੈ ਪਰ ਮੈਨੇ ਖੁਦ ਐਕਸਪੀਰੀਅੰਸ ਨਹੀਂ ਕੀਤਾ ਪਰ ਇਹਨਾਂ ਦੇ ਰਿਵਿਊ ਚੰਗੇ ਹੋਣ ਕਾਰਨ ਇਨ ਫਿਊਚਰ ਜੇਕਰ ਮੈਨੂੰ ਦੇਸ਼ ਤੋਂ ਬਾਹਰ ਘੁੰਮਣ ਜਾਣ ਦੀ ਅਵਸ਼ੱਕਤਾ ਹੋਈ ਤਾਂ ਮੈਂ ਇਹਨਾਂ ਨੂੰ ਜ਼ਰੂਰ ਸੰਪਰਕ ਕਰੂੰਗੀ